ਮੇਰਾ ਕੋਈ ਇੱਕ ਪਸੰਦੀਦਾ ਗਾਣਾ ਨਹੀਂ ਹੈ ਬਹੁਤ ਸਾਰੇ ਅਤੇ ਕਿਵੇਂ ਦਾ ਮੇਰਾ ਮੂਡ ਹੈ ਉਹਦੇ 'ਤੇ ਵੀ ਡਿਪੈਂਡ ਕਰਦਾ ਹੈ ਕਿ ਮੈਂ ਕਿਹੜੇ ਗਾਣੇ ਸੁਣਨਾ ਪਸੰਦ ਕਰ ਰਹੀ ਹਾਂ ਉਸ ਵੇਲੇ ਜਾਂ ਕਿਹੜੇ ਗਾਣੇ ਮੈਨੂੰ ਗਾਣਾ ਪਸੰਦ ਹੈ ਉਸ ਵੇਲੇ ਅਤੇ ਅੱਜ ਕੱਲ ਤਾਂ ਮੇਰੇ ਦਿਮਾਗ਼ 'ਚ ਸਤਿੰਦਰ ਸਰਤਾਜ ਜੀ ਦਾ ਗਾਣਾ ਬੁਲਾਣਾ ਨੀ ਆਇਆ ਅਤੇ ਬੀਤ ਜਾਣੀਆਂ ਮੈਨੂੰ ਬਹੁਤ ਪਸੰਦ ਹੈ ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ ਜੇ ਨਾ ਮਾਣੀਆਂ ਟੋਲਦਾ ਰਹੀਂ ਅਤੇ ਬੀਰ ਸਿੰਘ ਜੀ ਦਾ ਮਿਲਦੇ ਜਦੋਂ ਹਾਂ ਤੂੰ ਤੇ ਮੈਂ ਅੰਬਰ ਨੀਂਓਕੇ ਸਾਨੂੰ ਵੇਖਦੇ ਅਤੇ ਇੱਕ ਗਾਣਾ ਜੋ ਮੇਰੇ ਦਿਲ ਦੇ ਹਮੇਸ਼ਾ ਕਰੀਬ ਰਿਹਾ ਹੈ ਉਹ ਹੈ ਰਾਹਤ ਫਤਿਹ ਅਲੀ ਖਾਨ ਜੀ ਦਾ ਮੈਂ ਜਹਾਂ ਰਹੂੰ ਮੈਂ ਕਹੀਂ ਭੀ ਹੂੰ ਤੇਰੀ ਯਾਦ ਸਾਥ ਹੈ ਕਹਿਨੇ ਕੋ ਸਾਥ ਅਪਨੇ ਇੱਕ ਦੁਨੀਆਂ ਚਲਤੀ ਹੈ ਪਰ ਛੁਪਕੇ ਇਸ ਦਿਲ ਮੇ ਤਨਹਾਈ ਪਲਤੀ ਹੈ ਅਤੇ ਇਹ ਗਾਣਾ ਮੈਨੂੰ ਬਹੁਤ ਪਸੰਦ ਹੈ